ਹੈਲੋ ਹਾਂਜੀ ਸ਼ਾਮ ਢਾਬਾ ਦੇ ਵਿੱਚੋ ਬੋਲ ਰਹੇ ਹੋ ਤੁਸੀਂ ਅਸੀਂ ਆਪਣੇ ਪਰਿਵਾਰ ਨਾਲ ਢਾਬੇ 'ਤੇ ਖਾਣਾ ਖਾਣ ਆਉਣਾ ਸੀਗਾ ਅਤੇ ਇਸ ਲਈ ਅਸੀਂ ਤੁਹਾਡੇ ਤੋਂ ਢਾਬੇ ਦੇ ਖੁੱਲ੍ਹਣ ਦਾ ਟੈਮ ਰੈਸਟੋਰੈਂਟ ਦੇ ਖੁੱਲਣ ਦਾ ਟਾਈਮ ਅਤੇ ਇਸਦੇ ਬੰਦ ਹੋਣ ਦਾ ਟਾਈਮ ਅਤੇ ਟੇਬਲ ਕੋਈ ਖਾਲੀ ਅਤੇ ਇਹਦੇ ਬਾਰੇ ਪਤਾ ਕਰਨਾ ਸੀ ਇਹ ਵੀ ਪਤਾ ਕਰਨਾ ਸੀ ਕਿ ਤੁਸੀਂ ਆਪਣੇ ਰੈਸਟੋਰੈਂਟ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਕਿੰਨੇ ਤਰ੍ਹਾਂ ਦੀਆਂ ਦਾਲਾਂ ਅਤੇ ਰੋਟੀ ਦੀਆਂ ਕਿੰਨੀਆਂ ਕਿਸਮਾਂ ਤਿਆਰ ਕਰਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਆਈਸਕ੍ਰੀਮ ਗਰਮ ਗੁਲਾਬ ਜਾਮਣ ਜਾਂ ਗਜਰੇਲਾ ਵੀ ਆਪਣੇ ਰੈਸਟੋਰੈਂਟ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਵੀ ਦਾਲ ਦੀ ਅਤੇ ਸਬਜ਼ੀ ਦੀ ਪਲੇਟ ਅਤੇ ਰੋਟੀ ਦਾ ਰੇਟ ਅਤੇ ਬਾਕੀ ਐਟਮਾਂ ਦੇ ਰੇਟ ਬਾਰੇ ਵੀ ਤੁਹਾਡੇ ਤੋਂ ਪਤਾ ਕਰਨਾ ਸੀਗਾ ਵੀ ਤੁਸੀਂ ਕਿੰਨਾ ਰੈਂਟ ਲੈਂਦੇ ਹੋ ਅਤੇ ਤੁਹਾਡਾ ਜਿਹੜਾ ਇਹ ਰੈਸਟੋਰੈਂਟ ਹੈ ਕੀ ਇਹ ਇਸ ਸਾਰਾ ਏਸੀ ਹੈ ਅਤੇ ਇਹਦੇ ਵਿੱਚ ਬਾਕੀ ਜਿਵੇਂ ਵਧੀਆ ਪਾਣੀ ਦਾ ਵੀ ਪ੍ਰਬੰਧ ਹੈਗਾ ਗਾ ਅਤੇ ਇਹਦੇ ਵਿੱਚ ਵੀ ਜ਼ਿਆਦਾ ਰੱਸ਼ ਤਾਂ ਨਹੀਂ ਹੁੰਦਾ ਵੀ ਅਸੀਂ ਆਪਣੀ ਟੇਬਲ ਦੇ ਟੇਬਲ ਆ ਜਿਹੜਾ ਉਹ ਕਲੀਅਰ ਹੁੰਦਾ ਭਾਂਡੇ ਜਿਹਨਾਂ ਦੇ ਵਿੱਚ ਅਸੀਂ ਖਾਣਾ ਪੀਣਾ ਵੀ ਉਹ ਵੀ ਪੂਰੀ ਤਰ੍ਹਾਂ ਸਾਫ ਹੁੰਦੇ ਨੇਗੇ ਅਤੇ ਖਾਣਾ ਪੀਣਾ ਵੀ ਜੋ ਉਹ ਵਧੀਆ ਸਾਫ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਗਾ ਅਤੇ ਇਹ ਸਾਰਾ ਕੁਛ ਪਤਾ ਕਰਨਾ ਸੀਗਾ ਅਤੇ ਇਹਦੇ ਵਿੱਚ ਵੀ ਤੁਸੀਂ ਸਾਡੇ ਤੋਂ ਕਿੰਨਾ ਰੈਂਟ ਲਉਂਗੇ ਇਹ ਵੀ ਅਤੇ ਵੀ ਤੁਹਾਡੀ ਕੁਆਲਿਟੀ ਰੋਟੀ ਦੀ ਜਾਂ ਦਾਲ ਸਬਜ਼ੀ ਦੀ ਕਿਸ ਤਰ੍ਹਾਂ ਦੀ ਹੋਵੇਗੀ ਇਹ ਵੀ ਅਸੀਂ ਤੁਹਾਡੇ ਤੋਂ ਪਤਾ ਕਰਨਾ ਸੀ